ਅਸੀਂ ਜੇਕਰ ਵੀ ਕੋਈ ਵੀ ਕੈਂਪ ਦੇ ਨਾਲ ਸੰਬੰਧਿਤ ਕੋਈ ਵੀ ਚੀਜ਼ਾਂ ਕਰਦੇ ਹਾਂ ਤਾਂ ਅਸੀਂ ਆਪ ਦੇ ਘਰ ਦੇ ਸਭ ਤੋਂ ਵੱਡੇ ਮਹਿਲ ਗੱਲਬਾਤ ਕਰਾਂਗੇ ਅਤੇ ਜੇ ਉਹਨਾਂ ਨੂੰ ਗੱਲਬਾਤ ਕਰਕੇ ਜੇ ਉਹਨਾਂ ਨੇ ਸਾਨੂੰ ਹਾਂ ਕਹਿਤਾ ਤਾਂ ਅਸੀਂ ਕੈਂਪਲ ਕੈਂਪ 'ਤੇ ਜਾਵਾਂਗੇ ਅਤੇ ਅਸੀਂ ਉਸ ਮਤਲਬ ਕੋਈ ਵੀ ਜ਼ਿਲ੍ਹੇ 'ਚ ਕੋਈ ਵੀ ਸ਼ਹਿਰ 'ਚ ਕੈਂਪ ਲੱਗਿਆ ਹੋਵੇ ਉੱਥੋਂ ਉੱਥੇ ਜਾ ਕੇ ਖੇਡਾਂ ਦੇ ਕਹਿਣ 'ਤੇ ਜਿੱਥੇ ਖੇਡਾਂ ਦੀ ਸਿਖਲਾਈ ਦੇ ਕੈਂਪ ਬਣੇ ਹੁੰਦੇ ਸੀ ਖੇਡਾਂ ਦੇ ਸਪੋਰਟਸ ਗਰਾਊਂਡ ਬਣੇ ਹੁੰਦੇ ਆ ਅਸੀਂ ਉੱਥੇ ਜਾ ਕੇ ਉੱਥੇ ਜਾ ਕੇ ਉਹਨਾਂ ਕੋਚਾਂ ਨਾਲ ਗੱਲਬਾਤ ਕਰਾਂਗੇ ਅਤੇ ਗੱਲਬਾਤ ਕਰਕੇ ਅਤੇ ਅਸੀਂ ਆਪ ਦੇ ਘਰ ਦੱਸਾਂਗੇ ਜੇ ਸਾਡੇ ਘਰ ਦੇ ਮੰਨਗੇ ਤਾਂ ਅਸੀਂ ਫੀਸ ਪੇ ਕਰਾਂਗੇ ਅਤੇ ਉਹਨਾਂ ਨੇ ਸਾਨੂੰ ਵਧੀਆ ਕੋਚਿੰਗ ਦਿੱਤੀ ਤਾਂ ਅਸੀਂ ਉਹਨਾਂ ਨੂੰ ਪੂਰੀ ਦੀ ਪੂਰੀ ਫੀਸ ਦੇਵਾਂਗੇ ਅਤੇ ਜੇਕਰ ਉਹਨਾਂ ਨੇ ਸਾਨੂੰ ਕੰਮ ਤੋਂ ਕੰਮ ਵਧੀਆ ਕੋਈ ਚੀਜ਼ ਨਾ ਸਿਖਾਈ ਤਾਂ ਅਸੀਂ ਉਹਨਾਂ ਨੂੰ ਮਤਲਬ ਹਾਫ ਅੱਧੀ ਫੀਸ ਦੇਵਾਂਗੇ ਅਤੇ ਸਾਨੂੰ ਘਰ ਵਿੱਚ ਬਹੁਤ ਵਦ ਵਧੀਆ ਤੋਂ ਵਧੀਆ ਉਹ ਕੰਮ ਕਰਨਾ ਪੈਂਦਾ ਅਤੇ ਉਹ ਇਸ ਇਸ ਕਾਰਨ ਕਿ ਅਸੀਂ ਆਪ ਦੇ ਪੇਰੈਂਟਸ ਨਾਲ ਗੱਲ ਕਰਕੇ ਸਲਾਹ ਕਰਕੇ ਅਤੇ ਅਸੀਂ ਆਪ ਦੇ ਖੇਡਾਂ ਬਾਰੇ ਜਾਣਕਾਰੀ ਕਰਾਂਗੇ ਉਪਲਬਧ ਬਾਰੇ ਇਸ ਪੁੱਛਗਿਛ ਕਰਕੇ ਅਸੀਂ ਖੇਡਾਂ ਦੀ ਸਿਖਲਾਈ ਦੇ ਕੈਪ ਵਿੱਚ ਹਾਜ਼ਰ ਹੋਵਾਂਗੇ ਅਤੇ ਅਸੀਂ ਜੋ ਕੁਛ ਵੀ ਸਿਖਾਂਗੇ ਅਸੀਂ ਜੇ ਖੇਡਾਂ ਵਿੱਚ ਕੁਛ ਵੀ ਕਰੀਏ ਅਸੀਂ ਆਪ ਆਪ ਦੇ ਸਰੀਰ ਨੂੰ ਸੁਰੱਖਿਅਤ ਕਰਾਂਗੇ ਨਸ਼ਿਆਂ ਤੋਂ ਦੂਰ ਰਹਿ ਸਕਦੇ ਹਾਂ ਅਤੇ ਅਸੀਂ ਸਾਡੇ ਘਰ ਦੇ ਮੰਨਣਗੇ ਸਾਡੇ ਘਰ ਦਾ ਨਾਮ ਉੱਚਾ ਹੋਊਗਾ ਸਾਡੇ ਪਿੰਡ ਦਾ ਨਾਮ ਉੱਚਾ ਹੋਊਗਾ ਸਾਡੇ ਪਿੰਡ ਦਾ ਨਾਮ ਉੱਚਾ ਹੋਊਗਾ ਸਾਡੀ ਸੋਸਾਇਟੀ ਦਾ ਨਾਮ ਉੱਚਾ ਹੋਊਗਾ ਕਿ ਜਵਾਕ ਆਹ ਜਵਾਕ ਨੇ ਇੰਨਾ ਵਧੀਆ ਖੇਡਾਂ ਖੇਡੀਆਂ ਅਤੇ ਅਸੀਂ ਉਸ ਕੋਚ ਦਾ ਧੰਨਵਾਦ ਕਰਾਂਗੇ ਅਤੇ ਜਿਹਨੇ ਸਾਨੂੰ ਇਹ ਮਤਲਬ ਚੀਜ਼ਾਂ ਸਿਖਾਈਆਂ ਅਤੇ ਅਸੀਂ ਵਧੀਆ ਤੋਂ ਵਧੀਆ ਅਸੀਂ ਪਾਰਟੀਸਪੇਟ ਕਰਾਂਗੇ ਅਤੇ ਵਧੀਆ ਤੋਂ ਵਧੀਆ ਖੇਡਾਂਗੇ ਅਤੇ ਜੋ ਕਿ ਮੇਰੇ ਸਾਡੇ ਘਰਦਿਆਂ ਨੂੰ ਸਾਡੇ 'ਤੇ ਮਾਣ ਹੋ